ਹਾਂਜੀ ਨਮਸ਼ਕਾਰ ਜੀ ਜੀ ਮੈਂ ਨਾ ਐਕਚੁਲੀ ਘਰ ਲਿਆ ਵਾ ਅਤੇ ਮੇਰੇ ਕੋਲ ਨਾ ਕਾਫੀ ਜਗ੍ਹਾ ਪਈ ਹੈ ਅਤੇ ਫਾਲਤੂ ਜਗ੍ਹਾ ਪਈ ਹੈ ਅਤੇ ਮੈਂ ਉੱਥੇ ਗਾਰਡਨਿੰਗ ਦਾ ਕੁਛ ਕਰਨਾ ਵਾ ਥੋੜਾ ਅਤੇ ਮੈਂ ਫੁੱਲ ਬੂਟੇ ਥੋੜੇ ਪੌਦੇ ਉਗਾਨੇ ਆ ਤਾਂ ਦੱਸੋ ਕਿਹੜੀ ਚੀਜ਼ ਵਧੀਆ ਰਹੇਗੀ ਫਿਰ ਮੈਂ ਉਸ ਬਾਰੇ ਤੁਹਾਡੇ ਨਾਲ ਡਿਸਕਸ ਕਰਨੀ ਸੀ ਠੀਕ ਹੈ ਜੀ ਥੈਂਕ ਯੂ ਜੀ ਅਗਰ ਮੈਨੂੰ ਕੋਈ ਪ੍ਰੋਬਲਮ ਆਈ ਤਾਂ ਫਿਰ ਮੈਨੂੰ ਮੈਂ ਫਿਰ ਤੁਹਾਨੂੰ ਦੁਬਾਰਾ ਕੋਲ ਕਰਾਂਗੀ ਠੀਕ ਠੀਕ ਹੈ ਜੀ ਓਕੇ ਜੀ